ਮੇਰਾ ਸਾਈਕਲ ਕਾਲੇ ਰੰਗ ਦਾ ਹੈ ਅਤੇ ਮੈਂ ਉਸ ਦੀ ਬਹੁਤ ਹੀ ਜ਼ਿਆਦਾ ਦੇਖਭਾਲ ਕਰਦੀ ਹਾਂ ਹੁਣ ਉਹ ਮੇਰੇ ਪਰਿਵਾਰ ਵਾਂਗ ਇੱਕ ਹਿੱਸਾ ਜਿਹਾ ਬਣ ਗਿਆ ਹੈ ਮੈਂ ਕਿਤੇ ਵੀ ਸੈਰ ਕਰਨ ਜਦੋਂ ਵੀ ਜਾਂਦੀ ਹਾਂ ਤਾਂ ਆਪਣੇ ਸਾਈਕਲ ਨੂੰ ਨਾਲ ਹੀ ਲੈ ਕੇ ਜਾਂਦੀ ਹਾਂ ਮੈਂ ਉਸ ਦਾ ਉਸ ਨੂੰ ਟਾਈਮ ਸਿਰ ਸਾਫ਼ ਕਰਦੀ ਹਾਂ ਮਤਲਬ ਹਰ ਛੁੱਟੀ ਵਾਲੇ ਦਿਨ ਉਸ ਨੂੰ ਧੋਂਦੀ ਹਾਂ ਅਤੇ ਸਾਈਕਲ ਚਲਾਉਣ ਨਾਲ ਮੇਰੀ ਸਿਹਤ ਵੀ ਠੀਕ ਰਹਿੰਦੀ ਹੈ ਉਸ ਨੂੰ ਮੈਂ ਪਾਣੀ ਨਾਲ ਸ ਧੋਂਦੀ ਹਾਂ ਅਤੇ ਹਾਂ ਮੈਨੂੰ ਲੱਗਦਾ ਹੈ ਕਿ ਸਾਈਕਲ ਚਲਾਉਣਾ ਕਈ ਵਾਰ ਥਕਾਵਟ ਵਾਲਾ ਹੋ ਜਾਂਦਾ ਹੈ ਕਿਉਂਕਿ ਅਗਰ ਅਸੀਂ ਜ਼ਿਆਦਾ ਦੂਰ ਜਾਣਾ ਹੋਏ ਤਾਂ ਸਾਈਕਲ 'ਤੇ ਨਹੀਂ ਜਾਇਆ ਜਾਂਦਾ ਫਿਰ ਸਾਨੂੰ ਥਕਾਵਟ ਹੋ ਜਾਂਦੀ ਹੈ ਅਗਰ ਅਸੀਂ ਕਿਤੇ ਨੇੜੇ ਜਾਣਾ ਹੋਏ ਜਾਂ ਸੈਰ ਲਈ ਫਿਰ ਸਾਡੀ ਸਿਹਤ ਲਈ ਸਾਈਕਲ ਚਲਾਉਣਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਸਾਈਕਲ ਨਾਲ ਸਾਡੀ ਬੋਡੀ ਜਿਹੜੀ ਆ ਉਹ ਵੀ ਤੰਦਰੁਸਤ ਚੁਸਤ ਰਹਿੰਦੀ ਹੈ ਅਤੇ ਸਾਨੂੰ ਮਤਲਬ ਜ਼ਿਆਦਾ ਬਿਮਾਰੀਆਂ ਵੀ ਨਹੀਂ ਲੱਗਦੀਆਂ ਸਾਡੀ ਐਕਸਰਸਾਈਜ਼ ਵੀ ਹੋ ਜਾਂਦੀ ਹੈ ਅਤੇ ਅਗਰ ਕਿ ਜ਼ਿਆਦਾ ਦੂਰ ਜਾਣਾ ਹੋਏ ਦਸ ਕਿਲੋਮੀਟਰ ਵੀਹ ਕਿਲੋਮੀਟਰ ਅਤੇ ਉਸ ਨਾਲ ਸਾਡੀ ਥਕਾਵਟ ਹੋ ਜਾਂਦੀ ਹੈ ਅਸੀਂ ਸਾਈਕਲ 'ਤੇ ਇੰਨਾ ਦੂਰ ਸਫ਼ਰ ਨਹੀਂ ਕਰ ਸਕਦੇ ਬਾਕੀ ਅਗਰ ਹਾਂ ਅਸੀਂ ਕਿਤੇ ਲਾਗੇ ਜਾਣਾ ਹੋਏ ਤਾਂ ਸਾਨੂੰ ਸਾਈਕਲ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਅਸੀਂ ਲੰਬੇ ਰੂਟ 'ਤੇ ਸੁਚੇਤ ਅਤੇ ਪ੍ਰੇਰਿਤ ਰਹਿਣ ਲਈ ਸਾਨੂੰ ਆਪਣੇ ਸਾਈਡ ਚੱਲਣਾ ਚਾਹੀਦਾ ਹੈ ਅਤੇ ਸਾਨੂੰ ਗੱਡੀਆਂ ਮੋਟਰਾਂ ਦਾ ਇਸਤੇਮਾਲ ਬਹੁਤ ਹੀ ਸਹੀ ਤਰੀਕੇ ਨਾਲ ਕਰਨਾ ਚਾਹੀਦਾ ਹੈ ਜ਼ਿਆਦਾ ਸਪੀਟ ਨਹੀਂ ਚਲਾਉਣੀ ਚਾਹੀਦੀ ਅਤੇ ਆਪਣੀ ਸਾਈਡ ਰਹਿਣਾ ਚਾਹੀਦਾ ਹੈ ਬਹੁਤ ਹੀ ਸੁਚੇਤ ਰਹਿ ਕੇ ਰੋਡ ਉੱਤੇ ਸਾਈਕਲ ਹੋ ਗਿਆ ਮੋਟਰਸਾਈਕਲ ਹੋ ਗਿਆ ਕਾਰ ਹੋ ਗਈ ਇਹ ਬਹੁਤ ਹੀ ਧਿਆਨ ਨਾਲ ਇਹਨਾਂ ਦਾ ਉਪਯੋਗ ਕਰਨਾ ਚਾਹੀਦਾ ਹੈ ਅਤੇ ਸਭ ਤੋਂ ਵੱਡੀ ਗੱਲ ਸਾਨੂੰ ਕਦੇ ਵੀ ਸਪੀਡ ਵਿੱਚ ਕਿਤੇ ਨਹੀਂ ਜਾਣਾ ਚਾਹੀਦਾ ਆਰਾਮ ਨਾਲ ਹੀ ਹਰ ਇੱਕ ਚੀਜ਼ ਦਾ ਉਪਯੋਗ ਕਰਨਾ ਚਾਹੀਦਾ ਹੈ ਧੰਨਵਾਦ